ਜਿਵੇਂ ਕਿ ਸਾਨੂੰ ਸਭ ਨੂੰ ਹੀ ਪਤਾ ਹੈਗਾ ਕਿ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਕਲਾ ਅਤੇ ਸ਼ਿਲਪਕਾਰੀ ਦੇ ਵਿੱਚ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਮੁਹਾਰਤ ਹਲ ਹਾਸਲ ਹੈ ਉਹ ਮਤਲਬ ਕਿਤੇ ਨਾ ਕਿਤੇ ਪੰਜਾਬ ਅਤੇ ਪੰਜਾਬੀ ਜਿਹੜੇ ਹੈਗੇ ਆਪਣੀ ਕਲਾ ਅਤੇ ਸ਼ਿਲਪਕਰੀ ਲਈ ਜਾਣੇ ਜਾਂਦੇ ਹੈਗੇ ਆ ਉਹ ਉਹਨਾਂ ਦੀ ਬੋਲੀ ਦੇ ਲਈ ਜਾਣੇ ਜਾਂਦੇ ਹੈਗੇ ਆ ਉਹ ਉਹਨਾਂ ਦੇ ਸੁਭਾਅ ਲਈ ਜਾਣੇ ਜਾਂਦੇ ਹੈਗੇ ਆ ਪਰ ਕੀ ਹੈ ਇੱਥੇ ਕੀ ਕਲਾ ਅਤੇ ਸ਼ਿਲਪਕਾਰੀ ਦੀ ਭੂਮਿਕਾ ਅਲੱਗ ਹੀ ਹੈ ਅਲੱਗ ਅਲੱਗ ਹੀ ਹੈਗੀ ਆ ਉਹ ਹਰ ਇੱਕ ਵਿਦੇਸ਼ੀ ਨੂੰ ਆਪਣੇ ਵੱਲ ਅਟਰੈਕਟ ਕਰਦੀ ਹੈਗੀ ਆ ਅਤੇ ਕਿਤੇ ਨਾ ਕਿਤੇ ਮਤਲਬ ਕੀ ਹੈ ਪੰਜਾਬ ਵਿੱਚ ਰਹਿ ਰਹੇ ਜਿਹੜੇ ਵਾਂਝੇ ਸਮੂਹ ਹੈਗੇ ਆ ਠੀਕ ਆ ਉਹ ਮਤਲਬ ਉਹ ਹੈਰੀਟੇਜ ਹੈਗਾ ਜੋ ਮਤਲਬ ਇਹਨਾਂ ਚੀਜ਼ਾਂ ਤੋਂ ਵਾਂਝਾ ਰਹਿ ਗਿਆ ਹੈਗਾ ਉਹਨੂੰ ਵੀ ਕੀ ਹੈ ਉਹ ਪ੍ਰਭਾਵਿਤ ਕਰਦੇ ਹੈਗੇ ਆ ਠੀਕ ਹੈ ਉਹਨਾਂ ਲਈ ਕੀ ਹੈ ਸ਼ਸਤਰੀਕਰਨ ਨੂੰ ਸਮਾਜਿਕ ਅਤੇ ਉਹਨਾਂ ਲਈ ਆਰਥਿਕ ਸ਼ਸਤਰੀਕਰਨ ਦੇ ਰਸਤੇ ਕੀ ਹੈ ਖੋਲਦਾ ਹੈਗਾ ਠੀਕ ਹੈ ਉਹਦੇ ਲਈ ਕਿ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਹੈਗੀਆਂ ਚੀਜ਼ਾਂ ਇਹਨਾਂ ਚੀਜ਼ਾਂ ਤੋਂ ਕਿ ਇਹਨਾਂ ਇਸ ਲਈ ਜਿਹੜੇ ਪੰਜਾਬ ਵਿੱਚ ਰਹਿ ਰਹੇ ਜਿਹੜਾ ਵਾਂਝਾ ਵਾਂਝਾ ਵਰਗ ਠੀਕ ਹੈ ਉਹਨਾਂ ਨੂੰ ਕੀ ਹੈ ਇਹਦੇ ਲਈ ਇਹਦੇ ਲਈ ਕੀ ਹੈ ਉਹਨਾਂ ਨੂੰ ਹੈਲਪ ਹੁੰਦੀ ਹੈਗੀ ਉਹਨਾਂ ਦੇ ਰੋਜ਼ਗਾਰ ਦੇ ਲਈ ਉਹਨਾਂ ਨੂੰ ਰੁਜ਼ਗਾਰ ਦੇ ਵਿੱਚ ਬਹੁਤ ਹੈਲਪ ਹੁੰਦੀ ਹੈਗੀ ਹੈ ਤਾਂ ਉਹ ਆਪਣਾ ਰੋਜ਼ਗਾਰ ਚਲਾਉਂਦੇ ਹੈਗੇ ਠੀਕ ਹੈ ਉਹਨਾਂ ਲਈ ਜੀ ਕਿ ਆਰਥਿਕ ਜਿਹੜੀ ਸਹਾਇਤਾ ਹੁੰਦੀ ਹੈਗੀ ਆ ਉਹਨਾਂ ਨੂੰ ਆਰਥਿਕ ਸਮਾਜਿਕ ਸਹਾਇਤਾ ਹੁੰਦੀ ਹੈ ਅਤੇ ਸਮਾਜ ਵਿੱਚ ਆਪਣਾ ਕੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਰੁਤਬਾ ਮਿਲ ਜਾਂਦਾ ਹੈਗਾ ਜੀ ਹਾਂਜੀ